ਮੈਂ ਰਿਟਾਇਰ ਹੋ ਚੁੱਕਿਆ ਹਾਂ ਆਪਣੀ ਨੌਕਰੀ ਬੜੀ ਖੁਸ਼ੀ ਭਰਿਆ ਬਤੀਤ ਕੀਤੀ ਹੈ ਬਿਨਾਂ ਦਾਗ ਤੋਂ ਔਰ ਆਉਣ ਵਾਲ਼ੇ ਸਮੇਂ ਦੇ ਵਿੱਚ ਮੈਂ ਆਪਣੇ ਕੈਰੀਅਰ ਬਾਰੇ ਅਤੇ ਬੱਚਿਆਂ ਦੇ ਭਵਿੱਖ ਬਾਰੇ ਬੱਚਿਆਂ ਦੇ ਭਵਿੱਖ ਬਾਰੇ ਸੋਚਦਾਂ ਕਿ ਅੱਛੇ ਬੱਚੇ ਬਣਨ ਅੱਛੀ ਵਿੱਦਿਆ ਹਾਸਿਲ ਕਰਨ ਵਧੀਆ ਸੁੱਖ ਆਰਾਮ ਦੇ ਵਿੱਚ ਰਹਿਣ ਪਰ ਸੁੱਖ ਆਰਾਮ ਤਦ ਮਿਲਦਾ ਹੈ ਜਦੋਂ ਅਸੀਂ ਮਿਹਨਤ ਕਰਦੇ ਹਾਂ ਮਿਹਨਤ ਦੇ ਨਾਲ਼ ਹੀ ਸਾਡਾ ਕੈਰੀਅਰ ਆ ਮਿਹਨਤ ਦੇ ਨਾਲ਼ ਹੀ ਸਾਡਾ ਭਵਿੱਖ ਹੈ